ਮੈਂ ਇੱਕ ਜਾਨਵਰ ਦੀ ਫੋਟੋ ਸ਼ੂਟ ਕਰ ਰਿਹਾ ਸੀ ਅਤੇ ਅਚਾਨਕ ਹੀ ਉਹ ਭੱਜ ਗਿਆ ਮੈਂ ਉਹਦੇ ਪਿੱਛੇ ਗਿਆ ਫੋਟੋ ਸਾਫ ਨਹੀ ਆ ਰਹੀ ਸੀ ਫਿਰ ਮੈਂ ਰੀਕਵਰ ਕਰਕੇ ਫਿਰ ਖਿੱਚਣ ਲੱਗਿਆ ਫਿਰ ਫਿਰ ਐਵੇਂ ਹੋਈ ਜਾਂਦਾ ਸੀ ਫਿਰ ਉਹ ਮੇਰੇ ਪਿੱਛੇ ਪੈ ਗਿਆ ਮੈਂ ਭੱਜ ਗਿਆ ਫਿਰ ਫਿਰ ਮੈਂ ਆਇਆ ਉਹਦੀ ਫੋਟੋ ਖਿੱਚਣ ਲੱਗਿਆ ਇੱਕ ਇੱਕ ਫੋਟੋ ਉਹਨਾਂ ਦੀ ਆ ਗਈ ਸਾਫ ਜਿਹੀ ਅਤੇ ਫਿਰ ਸਾਫ ਨਹੀਂ ਆ ਰਹੀ ਸੀ ਮੈਂ ਡਿਲੀਟ ਕਰ ਕਰ ਕੇ ਬਹੁਤ ਕੋਸ਼ਿਸ਼ ਕੀਤੀ ਵੀ ਸਾਫ ਫੋਟੋ ਆਵੇ ਉਸ ਦੀ ਫੋਟੋ ਬਹੁਤ ਹੀ ਖਰਾਬ ਆ ਰਹੀ ਸੀ ਅਤੇ ਫਿਰ ਮੈਂ ਜਦੋਂ ਉਹ ਇੱਕ ਜਗ੍ਹਾ 'ਤੇ ਸ਼ਾਂਤ ਹੋ ਕੇ ਬਹਿ ਗਿਆ ਤਾਂ ਮੈਂ ਇੱਕ ਸ਼ਾਨਦਾਰ ਫੋਟੋ ਖਿੱਚੀ ਜੋ ਕਿ ਉਸ ਦੀ ਫੋਟੋ ਮੈਂ ਮੈਂ ਬਹੁਤ ਹੀ ਪਸੰਦ ਕਰਦਾ ਹਾਂ ਉਹ ਫੋਟੋ ਮੇਰੇ ਦਿਨ ਮੇਰੇ ਉਸ ਦਿਨ ਦੀ ਬਹੁਤ ਹੀ ਜ਼ਿਆਦਾ ਖੁਸ਼ੀ ਸੀ ਵੀ ਉਹ ਫੋਟੋ ਓਸ ਪੰਛੀ ਦੀ ਮੈਨੂੰ ਫੋਟੋ ਖਿੱਚਣ ਵਾਸਤੇ ਮਿਲ ਗਈ ਉਹ ਇੰਡੀਆ ਦਾ ਸਭ ਤੋਂ ਪਹਿਲਾਂ ਪੰਛੀ ਦੇਖਿਆ ਸੀ ਮੈਂ